ਸਾਡੇ ਸ਼ਹਿਰ ਪਟਿਆਲਾ ਤੋਂ ਪੰਜਾਹ ਕਿਲੋਮੀਟਰ ਦੂਰ ਇੱਕ ਬਿਰਧ ਆਸ਼ਰਮ ਹੈ ਥੋੜ੍ਹੇ ਦਿਨ ਪਹਿਲਾਂ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਮੈਂ ਉੱਥੇ ਜਾ ਕੇ ਬਿਰਧ ਲੋਕਾਂ ਦੀ ਸੇਵਾ ਕੀਤੀ ਮੈਂ ਉਹਨਾਂ ਦੇ ਲਈ ਆਪਣੇ ਘਰ ਤੋਂ ਬਣਾ ਕੇ ਖਾਣਾ ਲੈ ਗਈ ਸੀ ਉਹਨਾਂ ਨੇ ਘਰ ਦਾ ਖਾਣਾ ਖਾ ਕੇ ਬਹੁਤ ਹੀ ਖੁਸ਼ੀ ਮਹਿਸੂਸ ਕੀਤੀ ਅਤੇ ਮੈਨੂੰ ਬਹੁਤ ਹੀ ਅਸੀਸਾਂ ਦਿੱਤੀਆਂ ਉਹ ਲੋਕ ਬਹੁਤ ਹੀ ਸਾਫ਼ ਦਿਲ ਦੇ ਸਨ ਅਤੇ ਬਹੁਤ ਹੀ ਦਰਦਨਾਕ ਕਹਾਣੀਆਂ ਸਨ ਮੈਂ ਇੱਕ ਇੱਕ ਦੇ ਕੋਲ ਬੈਠ ਕੇ ਉਹਨਾਂ ਦੇ ਦੁੱਖ ਸੁਣਨ ਦੀ ਕੋਸ਼ਿਸ਼ ਕੀਤੀ ਮੈਨੂੰ ਬਹੁਤ ਹੀ ਦੁੱਖ ਮਹਿਸੂਸ ਹੋ ਰਿਹਾ ਸੀ ਕਿ ਅੱਜ ਕੱਲ੍ਹ ਲੋਕ ਆਪਣੇ ਮਾਂ ਬਾਪ ਨੂੰ ਬਿਰਧ ਆਸ਼ਰਮ ਦੇ ਵਿੱਚ ਕਿਉਂ ਛੱਡ ਦਿੰਦੇ ਹਨ ਮੈਂ ਉਹਨਾਂ ਦੇ ਨਾਲ ਦੁੱਖ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦਾ ਦਰਦ ਵੰਡਣ ਦੀ ਕੋਸ਼ਿਸ਼ ਕੀਤੀ ਮੈਂ ਚਾਹੁੰਦੀ ਹਾਂ ਕਿ ਸਾਨੂੰ ਇੱਕ ਅੱਧੀ ਵਾਰ ਤਾਂ ਬਿਰਧ ਆਸ਼ਰਮ ਜਾ ਕੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ